ਬਾਈਕਰ ਕੋਲ ਬਾਇਕ ਚਲਾਉਣ ਲਈ ਇੱਕ ਬਾਈਕ ਦੀ ਬੇਸਿਕ ਨੌਲਜ ਹੋਣਾ ਬਹੁਤ ਜਰੂਰੀ ਆ ਜਿਵੇਂ ਕਿ ਬਾਇਕ ਦਾ ਇੰਜਨ ਕਿੰਨੀ ਕਪੈਸਿਟੀ ਦਾ ਜਿਵੇਂ ਕੀ ਇੱਕ ਬਾਇਕ ਵਿੱਚ ਸੋ ਕਪੈਸਿਟੀ ਦੀ ਇੰਜਨ ਵੀ ਹੋ ਸਕਦਾ ਤੇ ਇੱਕ ਸੋ ਦਸ ਇੱਕ ਸੋ ਦਸ ਸੀ ਸੀ ਵੀ ਹੋ ਸਕਦਾ ਉਹ ਉਸਨੂੰ ਪਤਾ ਹੋਣਾ ਚਾਹੀਦਾ ਹੈ ਤੇ ਬਾਈਕ ਦੇ ਛੋਕਰ ਵਧੀਆ ਹੋਣੇ ਚਾਹੀਦੇ ਹਨ ਤੇ ਇਹ ਭਰੇ ਹੋਣੇ ਚਾਹੀਦੇ ਹਨ ਤੇ ਤੇ ਬਾਇਕ ਦਾ ਚੈਨ ਸੈੱਟ ਵਧੀਆ ਕੰਪਨੀ ਦਾ ਹੋਣਾ ਚਾਹੀਦਾ ਤੇ ਪ੍ਰੋਪਰ ਕੱਸਿਆ ਹੋਇਆ ਤੇ ਪੂਰੀ ਤਰਹਾਂ ਵਰਕ ਕਰਦਾ ਹੋਵੇ ਤੇ ਬਾਇਕ ਦੇ ਵਿੱਚ ਜਿਹੜੇ ਟਾਇਰ ਹੁੰਦੇ ਹਨ ਉਹ ਵਧੀਆ ਕੰਪਨੀ ਤੇ ਹੋਣੇ ਚਾਹੀਦੇ ਹਨ ਤੇ ਵਧੀਆ ਕੰਮ ਕਰਨਾ ਜਿਵੇਂ ਕਿ ਬੈਕ ਬਾਇਕ ਵਿੱਚ ਐਮ ਆਰ ਐਫ ਸੀ ਆਰ ਟੀ ਆਦ ਕੰਪਨੀਆਂ ਦੇ ਟਾਇਰ ਪਵਾਉਣੇ ਚਾਹੀਦੇ ਹਨ ਤੇ ਬੈਕ ਦੀ ਟਿਊਬ ਬਹੁਤ ਵਧੀਆ ਕੰਪਨੀ ਹੋਣੀ ਚਾਹੀਦੀ ਹ ਤਾਂ ਜੋ ਤੁਸੀਂ ਪੰਚਰ ਨਾ ਹੋਵੇ ਤੇ ਨਾ ਹੀ ਉਹ ਖਰਾਬ ਹੋਵੇ ਤੇ ਇੱਕ ਵਾਰ ਮੈਂ ਸਾਪੁਰ ਤੇ ਜਾ ਰਿਹਾ ਸੀ ਮੇਰੀ ਬਾਇਕ ਦਾ ਟਾਇਰ ਵਿੱਚ ਪੈਂਚਰ ਹੋ ਗਿਆ ਜਿਸ ਦੌਰਾਨ ਮੈਨੂੰ ਉੱਥੇ ਰੁਕਣਾ ਪਿਆ ਤੇ ਮੇਰੇ ਕੋਲ ਬਾਈਕ ਵਿੱਚ ਇੱਕ ਟੂਲ ਕਿੱਟ ਰੱਖੀ ਹੋਈ ਸੀ ਜਿਸ ਨਾਲ ਮੈਂ ਆਪਣੀ ਬਾਇਕ ਦਾ ਬਾਇਕ ਦੇ ਟਾਇਰ ਦਾ ਪੈਂਚਰ ਲਗਾਇਆ ਪੈਂਚਰ ਲਗਾਇਆ ਤੇ ਫਿਰ ਮੈਂ ਆਪਣਾ ਸਫਰ ਤੈਅ ਕੀਤਾ